ਹਾਂ ਮੈਂ ਕੈਮਰੇ ਨਾਲ ਤਸਵੀਰਾਂ ਖਿੱਚਦੀ ਹਾਂ ਇਹ ਮੇਰੇ ਲਈ ਬਹੁਤ ਹੀ ਸੁਖਮਈ ਤਰੀਕਾ ਹੈ ਆਪਣੀਆਂ ਯਾਦਾਂ ਦੇ ਅਨੁਭਵ ਨੂੰ ਸੰਜੀਵ ਰੂਪ ਦੇ ਵਿੱਚ ਯਾਦ ਰੱਖਣ ਦਾ ਮੈਂ ਸਾਡੇ ਸਥਾਨਕ ਯਾਤਰਾਵਾਂ ਖੇਡਾਂ ਅਤੇ ਸਾਹਿਤਕਾਰੀ ਨੇਚਰ ਦੇ ਸੰਬੰਧੀ ਸਮਾਗਮਾਂ ਦੀਆਂ ਤਸਵੀਰਾਂ ਕੱਢਦੀ ਰਹਿੰਦੀ ਹਾਂ ਖਿੱਚਦੀ ਰਹਿੰਦੀ ਹਾਂ ਇਹ ਮੇਰੇ ਅਨੁਕੂਲਾਂ ਨੂੰ ਸਾਂਝਾ ਕਰਨ ਦਾ ਇੱਕ ਬਹੁਤ ਵਧੀਆ ਤਰੀਕਾ ਹੈ ਮੇਰੇ ਦੋਸਤਾਂ ਅਤੇ ਪਰਿਵਾਰਾਂ ਨੂੰ ਮੇਰੇ ਸਾਥ ਨਾਲ ਲੈ ਜਾਣਾ ਇੱਕ ਤਰੀਕਾ ਹੈ ਜਿਸ ਨਾਲ ਅਸੀਂ ਇੱਕ ਸਾਥ ਸੰਬੰਧਾਂ ਨੂੰ ਵਧਾਉਣ ਲਈ ਸਮੇਂ ਬਤੀਤ ਕਰਦੇ ਹਾਂ ਮੈਂ ਤਸਵੀਰਾਂ ਖਿਚਣ ਨਾਲ ਸਥਾਨਿਕ ਵਿਚਾਰ ਅਤੇ ਸਮੱਗਰੀ ਨੂੰ ਬਣਾਉਣ ਵਿੱਚ ਰੁਚੀ ਰੱਖਦੀ ਹਾਂ ਇਹ ਮੇਰੇ ਲਈ ਇੱਕ ਸਰਦਾਰ ਅਤੇ ਸਮਰੂਤ ਅਨੁਭਵ ਹੁੰਦਾ ਹੈ ਜਿਸ ਨਾਲ ਮੈਂ ਆਪਣੀ ਜ਼ਿੰਦਗੀ ਦੀ ਮੋਟੀ ਕਹਾਣੀ ਨੂੰ ਸਾਂਝਾ ਕਰ ਸਕਦੀ ਹਾਂ ਤੁਸੀਂ ਹੁਣ ਵੀ ਕੋਈ ਖਾਸ ਤਸਵੀਰ ਦੇਖਣ ਲਈ ਇੱਕ ਅਗਾਂਹ ਦੇ ਸਕਦੇ ਹੋ ਜਾਂ ਮੈਨੂੰ ਮੇਰੇ ਜੀਵਨ ਦੀ ਕਹਾਣੀ ਨੂੰ ਵਧਾਉਣ ਦੇ ਵਿੱਚ ਮਦਦ ਕਰ ਸਕਦੇ ਹੋ